ਮੇਰਾ ਨਾਮ ਗੀਤਾਂਜਲੀ ਹੈ ਮੈਂ ਐਮਾਜੋ ਐਮਾਜ਼ੋਨ ਐਪ 'ਤੇ ਔਡਰ ਬੁੱਕ ਕਰਵਾਇਆ ਸੀ ਮੇਰਾ ਔਡਰ ਦੁਪਹਿਰ ਦੇ ਲੰਚ ਦਾ ਸੀ ਉਹ ਔਡਰ ਮੈਂ ਆਪਣੇ ਸਕੂਲ ਦੇ ਅਡਰੈਸ 'ਤੇ ਮੰਗਵਾਇਆ ਸੀ ਕਿਸੇ ਕਾਰਨ ਵੱਸ ਮੇਰੇ ਸਕੂਲ ਵਿੱਚ ਅੱਜ ਹਾਫ ਡੇ ਹੋ ਗਿਆ ਹੈ ਇਸ ਕਰਕੇ ਮੈਨੂੰ ਇਹ ਔਡਰ ਉਸ ਐਡਰੈਸ 'ਤੇ ਨਹੀਂ ਚਾਹੀਦਾ ਕਿਰਪਾ ਕਰਕੇ ਤੁਸੀਂ ਮੇਰੇ ਘਰ ਵਾਲੇ ਅਡਰੈਸ 'ਤੇ ਇਹ ਔਡਰ ਭੇਜਣ ਦੀ ਕਿਰਪਾਲਤਾ ਕਰੋ ਮੇਰੇ ਘਰ ਦਾ ਐਡਰੈਸ ਹੈ ਆਦਰਸ਼ ਨਗਰ ਗਲੀ ਨੰਬਰ ਪੰਜ ਸੌ ਛੇ ਰੂਪਨਗਰ ਕਿਰਪਾ ਕਰਕੇ ਤੁਸੀਂ ਇਸ ਐਡਰੈਸ 'ਤੇ ਆਪਣੀ ਡਿਲੀਵਰੀ ਟਰਾਂਸਫਰ ਕਰ ਦੇਵੋ ਧੰਨਵਾਦ